ਇੱਕ ਕਲਾਕਾਰ ਦੇ ਰੂਪ ਵਿੱਚ ਮੇਨ ਚੁਣੌਤੀਆਂ ਦਾ ਚੁਣੌਤੀਆਂ ਤਾਂ ਇਹ ਸੀ ਕਿ ਜਿਹੜਾ ਸਾਡਾ ਡਰਾਇੰਗ ਦਾ ਲੈਕਚਰ ਸੀਗਾ ਉਸ ਦਾ ਟਾਈਮ ਬਹੁਤ ਘੱਟ ਸੀ ਹਫ਼ਤੇ ਵਿੱਚ ਵੀ ਸਿਰਫ਼ ਤਿੰਨ ਦਿਨ ਹੀ ਲਗਾਇਆ ਜਾਂਦਾ ਸੀ ਉਹਦੇ ਵਿੱਚੋਂ ਵੀ ਸ਼ਨੀਵਾਰ ਦੇ ਦਿਨ ਇੰਗਲਿਸ਼ ਵਾਲੇ ਸਰ ਲਗਾ ਕੇ ਬੈਠ ਜਾਂਦੇ ਸੀ ਅ ਅਖੀਰਲਾ ਪੀਰੀਅਡ ਹੁੰਦਾ ਸੀ ਇਹ ਸਾਡਾ ਲਾਸਟ 'ਤੇ ਛੁੱਟੀ ਦੇ ਟਾਈਮ ਤੋਂ ਟਾਈਮ ਦੇ ਵੇਲੇ ਦਾ ਲੈਕਚਰ ਹੁੰਦਾ ਸੀਗਾ ਅਤੇ ਜਿਹੜੇ ਨੂੰ ਇੰਗਲਿਸ਼ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ ਸਕੂਲਾਂ ਦੇ ਵਿੱਚ ਇੱਕ ਪੇਂਡੂ ਸਕੂਲ ਹੋਣ ਕਰਕੇ ਟੀਚਰਸ ਦਾ ਵੀ ਬਹੁਤ ਘੱਟ ਪ੍ਰਬੰਧ ਸੀਗਾ ਕਿਉਂਕਿ ਵੈਸੇ ਤਾਂ ਕਲਾਕਾਰ ਜਿਹੜੇ ਡਰਾਇੰਗ ਵਾਲੇ ਟੀਚਰ ਆ ਉਹਨਾਂ ਦੀਆਂ ਅਸਾ ਅਸਾਮੀਆਂ ਹਜੇ ਵੀ ਬਹੁਤ ਘੱਟ ਨੇਗੀਆਂ ਅਤੇ ਬੱਚਿਆਂ ਨੂੰ ਇਸ ਪਰ ਅੱਜ ਵੀ ਇਸ ਕੰਡੀਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਅਤੇ ਸਟੇਸ਼ਨਰੀ ਅਤੇ ਪ੍ਰੇਰਨਾ ਦੀ ਕਮੀ ਮੇਰੀ ਜ਼ਿੰਦਗੀ ਵਿੱਚ ਰਹੀ ਹੈ ਨਾ ਤਾਂ ਮੈਨੂੰ ਜ਼ਿਆਦਾ ਵਧੀਆ ਕੋਈ ਡਰਾਇੰਗ ਟੀਚਰ ਮਿਲਿਆ ਦੂਜੀ ਘਾਟ ਇਹ ਸੀ ਕਿ ਮੈਂ ਅੱਠਵੀਂ ਤੱਕ ਹੀ ਡਰਾਇੰਗ ਲਈ ਸੀਗੀ ਅਤੇ ਅੱਠਵੀਂ ਤੱਕ ਹੀ ਮੈਨੂੰ ਟੀਚਰ ਮਿਲੇ ਸੀ ਉਹ ਮੇਨ ਘਾਟ ਇਹ ਸੀ ਕਿ ਟਾਈਮ ਦੀ ਘਾਟ ਸੀਗੀ ਜੋ ਡਰਾਇੰਗ ਟੀਚਰ ਵੀ ਨਹੀਂ ਪੂਰੀ ਕਰ ਸਕਦੇ ਸੀਗੇ ਸਕੂਲ 'ਚ ਸਿਰਫ਼ ਨੌਂ ਹੀ ਲੈਕਚਰ ਲੱਗਦੇ ਸੀਗੇ ਜਿਹਦੇ ਵਿੱਚੋਂ ਬਾਕੀ ਲੈਕ ਉਸ ਸਬਜੈਕਟਾਂ ਦੇ ਲੈਕਚਰ ਸੀਗੇ ਜਿਹੜੇ ਉਹ ਦੋ ਦੋ ਹੋ ਜਾਂਦੇ ਸੀ ਡਰੈਂਗ ਦਾ ਜਿਹੜਾ ਇਕ ਲੈਕਚਰ ਆਉਂਦਾ ਸੀ ਹਫ਼ਤੇ 'ਚ ਉਹ ਤਿੰਨ ਦਿਨ ਲਾਸਟ ਦੇ ਤਿੰਨ ਦਿਨ ਉਹ ਚੋਂ ਵੀ ਮਿਸ ਕੀਤਾ ਜਾਂਦਾ ਸੀ ਇੱਕ ਲੈਕਚਰ ਲਾਸਟ ਵਾਲਾ ਸ਼ਨੀਵਾਰ ਵਾਲਾ ਤਾਂ ਇਸ ਕਰਕੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਇਹ ਪ੍ਰੇਰਣਾ ਪ੍ਰੇਰਣਾ ਵਾਲੇ ਟੀਚਰਾਂ ਦੀ ਵੀ ਘਾਟ ਹੋ ਗਈ ਜਦੋਂ ਟਾਈਮ ਦੀ ਘਾਟ ਹੋ ਗਈ ਬਾਕੀ ਪੇਂਡੂ ਏਰੀਏ 'ਚ ਸਕੂਲ ਸੀਗੇ ਮੇਨ ਗੱਲ ਇਹ ਸੀਗੀ ਥੈਂਕ ਯੂ